ਮੈਂ ਸਵਿੱਗੀ ਤੋਂ ਦੋ ਚੀਜ ਨਾਨ ਵਿਦ ਗ੍ਰੇਵੀ ਆਰਡਰ ਕੀਤੇ ਸੀ ਪਰ ਹੁਣ ਮੈਂ ਦੋ ਚੀਜ ਨਾਨ ਗ੍ਰੇਵੀ ਦੇ ਨਾਲ਼ ਨਾਲ਼ ਦੋ ਹੋਰ ਆਰਡਰ ਕਰਨਾ ਚਾਹੁੰਦੀ ਹਾਂ ਮਤਲਬ ਕਿ ਮੈਂ ਚਾਰ ਚੀਜ ਨਾਨ ਵਿਦ ਗ੍ਰੇਵੀ ਔਡਰ ਕਰਨਾ ਚਾਹੁੰਦੀ ਹਾਂ ਅਤੇ ਨਾਲ਼ ਦੋ ਗੁਲਾਬ ਜਾਮੁਨ ਵੀ ਔਡਰ ਕਰਨਾ ਚਾਹੁੰਦੀ ਹਾਂ ਕਿਰਪਾ ਕਰਕੇ ਤੁਸੀਂ ਮੇਰਾ ਆਰਡਰ ਚੇਂਜ ਕਰ ਦਿਓ ਐਂਡ ਮੈਨੂੰ ਦੋ ਦੀ ਜਗ੍ਹਾ 'ਤੇ ਚਾਰ ਚੀਜ ਨਾਨ ਵਿੱਦ ਗਰੇਵੀ ਦੇ ਦਿਓ ਅਤੇ ਨਾਲ਼ ਦੋ ਗੁਲਾਬ ਜਾਮੁਨ ਹੋਰ ਦੇ ਦਿਓ ਅਤੇ ਡਿਲੀਵਰੀ ਕਰਨ ਵਾਲੇ ਨੂੰ ਇਹ ਹਿਦਾਇਤ ਦੇ ਦਿਓ ਕਿ ਉਹ ਔਡਰ ਜਲਦੀ ਤੋਂ ਜਲਦੀ ਲੈ ਕੇ ਆ ਜਾਵੇ ਮੇਰੇ ਘਰ ਪ੍ਰਾਹੁਣੇ ਆਏ ਹੋਏ ਹਨ ਅਤੇ ਉਹ ਆਰਡਰ ਠੰਡਾ ਨਾ ਹੋ ਜਾਵੇ ਜੇ ਜੇਕਰ ਆਰਡਰ ਠੰਡਾ ਹੋ ਗਿਆ ਤਾਂ ਮੈਂ ਪੈਸੇ ਨਹੀਂ ਦੇਣੇ ਹੈਗੇ ਅਤੇ ਕਿਰਪਾ ਕਰਕੇ ਜਲਦੀ ਤੋਂ ਜਲਦੀ ਮੇਰਾ ਆਰਡਰ ਮੈਨੂੰ ਭੇਜ ਦਿੱਤਾ ਜਾਵੇ ਅਤੇ ਗਰਮ ਗਰਮ ਭੇਜ ਦਿੱਤਾ ਜਾਵੇ